ਟੈਕਨੋਲਜੀ ਨੇ ਯਾਤਰਾ ਉਦਯੋਗ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਂਦੀ ਹੈ ਅਤੇ ਇਸ ਨੂੰ ਬਿਲਕੁਲ ਬਦਲ ਦਿੱਤਾ ਹੈ ਜਿੱਥੇ ਪਹਿਲਾਂ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਕਾਫੀ ਸਮਾਂ ਅਤੇ ਮਿਹਨਤ ਲੱਗਦੀ ਸੀ ਉੱਥੇ ਹੁਣ ਇਹ ਟੈਕਨੋਲਜੀ ਦੀ ਮਦਦ ਨਾਲ ਇਹ ਕੁਝ ਹੀ ਕਲਿੱਕਾਂ ਵਿੱਚ ਹੋ ਜਾਂਦਾ ਹੈ ਆਓ ਦੇਖਦੇ ਹਾਂ ਕਿਵੇਂ ਤਿਕਨੋਲਜੀ ਨੇ ਯਾਤਰਾ ਉਦਯੋਗ ਨੂੰ ਬਦਲਿਆ ਹੈ ਟਿਕਟਾਂ ਅਤੇ ਹੋਟਲ ਬੁੱਕ ਕਰਨਾ ਕਈ ਵੈਬਸਾਈਟਾਂ ਆਨਲਾਈਨ ਅਤੇ ਟ੍ਰੇਵਲ ਏਜੰਸੀਆਂ ਨੇ ਟਿਕਟਾਂ ਅਤੇ ਹੋਟਲ ਬੁੱਕ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾ ਦਿੱਤਾ ਹੈ ਤੁਸੀਂ ਆਪਣੀ ਮਨਪਸੰਦ ਮੰਜ਼ਿਲ ਤਰੀਕ ਅਤੇ ਬਜਟ ਅਨੁਸਾਰ ਟਿਕਟ ਅਤੇ ਹੋਟਲ ਆਸਾਨੀ ਨਾਲ ਬੁੱਕ ਕਰ ਸਕਦੇ ਹਾਂ ਮੋਬਾਇਲ ਐਪਸ ਹੁਣ ਤੁਸੀਂ ਆਪਣੇ ਸਮਾਰਟ ਫੋਨ ਦੀ ਮਦਦ ਨਾਲ ਕਿਤੇ ਵੀ ਕਿਸੇ ਸਮੇਂ ਵੀ ਟਿਕਟ ਹੋਟਲ ਬੁੱਕ ਕਰ ਸਕਦੇ ਹੋ ਰੇਟਾਂ ਦੀ ਜਾਂਚ ਕਰਨਾ ਕੀਮਤੀ ਤੁਲਨਾ ਅਤੇ ਕਰਨ ਵਾਲੀਆਂ ਵੈਬਸਾਈਟਾਂ ਕਈ ਵੈਬਸਾਈਟਾਂ ਹਨ ਜੋ ਵੱਖ ਵੱਖ ਏਅਰਲਾਈਨ ਅਤੇ ਹੋਟਲ ਦੀਆਂ ਕੀਮਤਾਂ ਦੀ ਤੁਲਨਾ ਕਰਦੀਆਂ ਹਨ ਤਾਂ ਜੋ ਤੁਸੀਂ ਸਭ ਤੋਂ ਵਧੀਆ ਸੌਦਾ ਕਰ ਸਕਦੇ ਹੋ ਟ੍ਰੇਨ ਦੀ ਉਪਲਬਧਤਾ ਦੀ ਜਾਂਚ ਕਰਨਾ ਆਈ ਆਰ ਸੀ ਟੀ ਸੀ ਭਾਰਤ ਵਿੱਚ ਆਈ ਆਰ ਸੀ ਟੀ ਵੈਬਸਾਈਟ ਰਾਹੀਂ ਐਪ ਤੁਸੀਂ ਟਰੇਨ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਹੋ ਅਤੇ ਟਿਕਟ ਬੁੱਕ ਕਰ ਸਕਦੇ ਹੋ ਸ਼ਿਫਾਰਿਸ਼ ਦੀ ਵੀਡੀਓ ਦੇਖਣੀ ਯੂਟੀਊਬ ਅਤੇ ਹੋਰ ਪਲੇਟਫਾਰਮ ਯੂਟੀਊਬ ਅਤੇ ਪਲੇਟਫਾਰਮਾਂ 'ਤੇ ਤੁਸੀਂ ਕਿਸੇ ਵੀ ਮੰਜ਼ਿਲ ਬਾਰੇ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਤੁਹਾਨੂੰ ਉਸ ਜਗ੍ਹਾ ਬਾਰੇ ਜਾਣਕਾਰੀ ਦੇਣ ਵਿੱਚ ਮਦਦ ਕਰ ਸਕਦੀਆਂ ਹਨ ਤੁਹਾਡੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ ਮੌਸਮ ਦੀ ਜਾਂਚ ਮੌਸਮ ਐਪ ਮੌਸਮ ਐਪ ਦੀ ਮਦਦ ਨਾਲ ਤੁਸੀਂ ਕਿਸੇ ਵੀ ਜਗ੍ਹਾ ਦਾ ਮੌਸਮ ਜਾਣ ਸਕਦੇ ਹੋ ਆਪਣੀ ਯਾਤਰਾ ਲਈ ਕੱਪੜੇ ਪੈਕ ਕਰ ਸਕਦੇ ਹੋ